ਸਾਡਾ ਜ਼ਿਲ੍ਹੇ ਮੋਹਾਲੀ ਦੇ ਵਿੱਚ ਬਹੁਤ ਹੀ ਪੂਜਾ ਸਥਾਨ ਹਨ ਜਿਨ੍ਹਾਂ ਵਿੱਚ ਮੰਦਰ ਗੁਰਦੁਆਰੇ ਮਸਜਿਦਾਂ ਕਾਫੀ ਆਉਂਦੀਆਂ ਹਨ ਇਹ ਤਿਉਹਾਰ ਇਹਨਾਂ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਪਰੰਪਰਾਵਾਂ ਅਤੇ ਭਾਈਚਾਰੇ ਦਾ ਪ੍ਰਤੀਕ ਹਨ ਇਹਨਾਂ ਵਿੱਚ ਜਿਹੜੇ ਤਿਉਹਾਰ ਹੈਗੇ ਹੈ ਜਿਵੇਂ ਦੀਵਾਲੀ ਹੈ ਇਹ ਸਾਡੇ ਲਾਗੇ ਇੱਥੇ ਆਪਣੇ ਔਫਿਸ ਦੇ ਨਜ਼ਦੀਕ ਹੀ ਅੰਬ ਸਾਹਿਬ ਗੁਰਦੁਆਰਾ ਹੈਗਾ ਇੱਥੇ ਤਿੰਨ ਦਿਨਾਂ ਤੋਂ ਦੀਵਾਲੀ ਦਾ ਜਿਹੜਾ ਤਿਉਹਾਰ ਹੈਗਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਪਾਸੇ ਜਗਮਗ ਜਗਮਗ ਲਾਈਟਾਂ ਜਗਦੀਆਂ ਹਨ ਅਤੇ ਇਹ ਤਿੰਨ ਦਿਨ ਇਹ ਤਿਉਹਾਰ ਮਨਾਇਆ ਜਾਂਦਾ ਹੈ ਮੰਦਰਾਂ ਦੇ ਵਿੱਚ ਵੀ ਦੀਵਾਲੀ ਨੂੰ ਮਨਾਇਆ ਜਾਂਦਾ ਇਹ ਇੱਕ ਸਾਂਝਾ ਤਿਉਹਾਰ ਵੀ ਕਈ ਹੁੰਦੇ ਹਾਂ ਜਿਹੜੇ ਗੁਰਦੁਆਰਿਆਂ ਵਿੱਚ ਵੀ ਮਨਾਏ ਜਾਂਦੇ ਹਨ ਅਤੇ ਮੰਦਰਾਂ ਵਿੱਚ ਵੀ ਮਨਾਏ ਜਾਂਦੇ ਹਨ ਔਰ ਜਦੋਂ ਕੋਈ ਈਦ ਵਗੈਰਾ ਆਏ ਤਾਂ ਉਹ ਮਸਜਿਦਾਂ ਵਿੱਚ ਮਨਾਈ ਜਾਂਦੀ ਹੈ ਅਤੇ ਇਹਨਾਂ ਵਿੱਚੋਂ ਦੀਵਾਲੀ ਹੋ ਗਿਆ ਫਿਰ ਇਹ ਕਾਫੀ ਬਹੁਤ ਵੱਡੇ ਤਿਉਹਾਰ ਹਨ ਜਿਹੜੇ ਕਿ ਸਾਂਝੇ ਤੌਰ 'ਤੇ ਮਨਾਏ ਜਾਂਦੇ ਹਨ ਇੱਥੇ ਬਿਨਾਂ ਵਿਤਕਰੇ ਤੋਂ ਬਿਨਾਂ ਮਤ ਜਾਤ ਪੁੱਛੇ ਕੋਈ ਵੀ ਜਾ ਕੇ ਇਹਨਾਂ ਇਹਨਾਂ ਮਤਲਬ ਸਥਾਨਾਂ ਦੇ ਉੱਤੇ ਜਾ ਕੇ ਮੱਥਾ ਟੇਕ ਸਕਦਾ ਹੈ ਜਾਕੇ ਆਪਣਾ ਕੋਈ ਵੀ ਹਿੱਸਾ ਲੈ ਸਕਦਾ ਹੈ ਇਸ ਵਿੱਚ ਜਾ ਕੇ ਆਪਣੇ ਮਨ ਦੀ ਸ਼ਾਂਤੀ ਵਾਸਤੇ ਆਪਣੇ ਬੱਚਿਆਂ ਨੂੰ ਜਾ ਕੇ ਇਤਿਹਾਸ ਦੀ ਜਾਣਕਾਰੀ ਕਰਵਾਉਂਦੇ ਹਨ ਸਾਡਾ ਇਤਿਹਾਸਿਕ ਜਾਣ ਪਛਾਣ ਕੀ ਹੈ